ਹਾਂਜੀ ਮੇਰਾ ਇੱਕ ਸੂਟ ਖਰਾਬ ਹੋਇਆ ਸੀ ਕਢਾਈ ਕਰਦੇ ਸਮੇਂ ਉਹ ਸਿਲਾਈ ਕਰਦੇ ਸਮੇਂ ਵੀ ਕੋਲਰ ਗਲਾ ਬਣਾਉਂਦੇ ਸਮੇਂ ਦਿੱਕਤ ਆਈ ਸੀ ਤਾਂ ਮੈਂ ਉਸਨੂੰ ਵਾਰ ਵਾਰ ਉਧੇੜ ਕੇ ਯੂਟੀਊਬ ਦੀ ਮਦਦ ਨਾਲ ਉਸਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਠੀਕ ਹੋ ਰਿਹਾ ਸੀ ਤਾਂ ਮੈਂ ਆਪਣੇ ਨਜ਼ਦੀਕੀ ਦਰਜਾਨੀ ਕੋਲ ਗਈ ਤਾਂ ਉਹਦੀ ਮਦਦ ਨਾਲ ਉਹਦੀ ਸਮੱਸਿਆ ਨੂੰ ਦੂਰ ਕੀਤਾ ਉਹਨਾਂ ਨੂੰ ਪੁੱਛਿਆ ਕਿ ਇਹਦੇ ਵਿੱਚ ਕੀ ਦਿੱਕਤ ਆ ਰਹੀ ਹੈ ਇਹ ਕਿਉਂ ਨਹੀਂ ਸਹੀ ਆ ਰਿਹਾ ਤਾਂ ਆਂਟੀ ਨੇ ਸਮਝਾਇਆ ਜੋ ਜੋ ਉਹਦੇ ਵਿੱਚ ਦਿੱਕਤ ਸੀ ਉਹ ਸਾਰੀ ਮੈਨੂੰ ਸਮਝਾ ਕੇ ਦੂਰ ਕੀਤੀ ਤਾਂ ਮੈਂ ਇਸ ਅਨੁਭਵ ਤੋਂ ਇਹ ਸਿੱਖਿਆ ਕਿ ਕੋਸ਼ਿਸ਼ ਕਰਨ ਨਾਲ ਕਦੇ ਹਾਰ ਨਹੀਂ ਹੁੰਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਸਮਝ ਆਵੇ ਤਾਂ ਦੂਸਰਿਆਂ ਦੀ ਮਦਦ ਲੈ ਕੇ ਉਸ ਨੂੰ ਪੂਰਾ ਕਰ ਲੈਣਾ ਚਾਹੀਦਾ ਹੈ